ਹਾਂ ਸਰਕਾਰ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਪੈਸਾ ਖਰਚ ਕਰਨਾ ਚਾਹੀਦਾ ਹੈ ਅਤੇ ਹੋਰ ਫੰਡ ਜਾਰੀ ਕਰਨੇ ਚਾਹੀਦੇ ਹਨ ਜਿਸ ਨਾਲ ਖੇਡ ਖਿਡਾਰੀ ਦਾ ਮਨ ਖਿਡਾਰੀ ਨੂੰ ਪ੍ਰੋਸ਼ਾਹਨ ਪ੍ਰੋਤਸਾਹਨ ਮਿਲਦਾ ਹੈ ਖਿਡਾਰੀ ਅੱਗੇ ਵੱਲ ਵੱਧਦਾ ਹੈ ਇਹ ਨਹੀਂ ਕਿ ਕਿਸੇ ਵੀ ਖੇਡਾਂ ਵਿੱਚ ਜਦੋਂ ਉਹ ਆਪਣਾ ਰੁਝਾਨ ਦੱਸਦਾ ਹੈ ਕਿ ਰੁਝਾਨ ਨਾਲ ਕਿ ਜਦੋਂ ਖੇਡਦਾ ਹੈ ਤਾਂ ਉਸਨੂੰ ਅੱਗੇ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਕਿਸੇ ਵੀ ਖੇਡਾਂ ਵਿੱਚ ਕਿਸੇ ਵੀ ਫੀਲਡ ਵਿੱਚ ਜਦੋਂ ਅੱਗੇ ਜਾਂਦਾ ਹੈ ਅਤੇ ਵੱਧ ਤੋਂ ਵੱਧ ਕਿਸੇ ਇੱਕ ਮੈ ਮੈਡਲ ਮਿਲ ਜਾਣ ਨਾਲ ਉਸ ਦਾ ਸਭ ਕੁਛ ਖ਼ਤਮ ਕੰਮ ਉੱਥੇ ਹੀ ਖ਼ਤਮ ਹੋ ਜਾਂਦਾ ਹਾ ਉਸਨੂੰ ਅੱਗੇ ਰਸਤਾ ਕੋਈ ਦਿਖਾਈ ਨਹੀਂ ਦਿੰਦਾ ਕੁਛ ਸਰਕਾਰ ਨੂੰ ਹੋਰ ਫੰਡ ਜਾਰੀ ਕਰਨੇ ਚਾਹੀਦੇ ਹਨ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਪੈਸਾ ਖਰਚ ਕਰਨਾ ਚਾਹੀਦਾ ਹਨ ਅੱਜ ਕੱਲ੍ਹ ਅਜੋਕਾ ਇਹੀ ਹੋ ਗਿਆ ਕਿ ਕਿਸੇ ਫੀਲਡ ਵਿੱਚ ਬਹੁਤ ਹੀ ਲੋਕਾਂ ਨੂੰ ਗ ਖੇਡਾਂ ਵਿੱਚ ਅੱਗੇ ਵਧਣ ਦਾ ਰੁਝਾਨ ਹੈ ਪਰ ਹਾਲਾਤ ਹੀ ਇੰਝ ਦੇ ਅਜੋਕਾ ਸਮਾਂ ਇੰਝ ਦਾ ਹੀ ਹੋ ਗਿਆ ਹੈ ਕਿ ਉਹਨਾਂ ਨੂੰ ਅੱਗੇ ਕੋਈ ਰਾਹ ਹੀ ਨਹੀਂ ਦਿਖਾਈ ਦਿੰਦਾ ਉਸ ਉਹਨਾਂ ਦਾ ਰੁਝਾਨ ਘੱਟਦਾ ਜਾ ਰਿਹਾ ਹੈ ਕਿਉ ਅੱਗੇ ਉਹਨਾਂ ਨੂੰ ਕੋਈ ਫੀਲਡ ਵਿੱਚ ਅੱਗੇ ਵਧਣ ਲਈ ਉਹਨਾਂ ਨੂੰ ਪ੍ਰੋਤਸਾਹਨ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਚਾਹੀਦਾ ਕੀ ਇਸ ਵਿੱਚ ਹੋਰ ਫੰਡ ਜਾਰੀ ਕਰਨੇ ਚਾਹੀਦੇ ਹਨ ਹੁਣ ਕਈ ਖਿਡਾਰੀ ਇਸ ਤਰ੍ਹਾਂ ਦੇ ਹਨ ਸਿਰਫ਼ ਮੈਡਲ ਲੈ ਕੇ ਹੀ ਘਰ ਬੈਠੇ ਹਨ ਉਹਨਾਂ ਨੂੰ ਅੱਗੇ ਕੁਛ ਵੀ ਰਸਤਾ ਦਿਖਾਈ ਨਹੀਂ ਦਿੰਦਾ ਸਿਰਫ਼ ਮੈਡਲਾਂ ਨਾਲ ਹੀ ਨਹੀਂ ਗਾ ਗੱਲ ਬਣਦੀ ਇਸ ਲਈ ਉਹਨਾਂ ਦਾ ਰੁਝਾਨ ਘੱਟ ਹੋ ਰਿਹਾ ਬਹੁਤ ਸਾਰੇ ਕਬੱਡੀ ਜਾਂ ਕ੍ਰਿਕਟ ਖੋ ਖੋ ਬਹੁਤ ਸਾਰੇ ਖੇਡਾਂ ਹਨ ਸਰਕਾਰ ਨੂੰ ਇਹਨਾਂ ਵਿੱਚ ਹੋਰ ਫੰਡ ਜਾਰੀ ਕਰਨੇ ਚਾਹੀਦੇ ਹਨ ਅਤੇ ਇਸ ਤਰ੍ਹਾਂ ਜਿਹੜੀ ਆਪਣੀ ਪੰਜਾਬ ਦੀ ਪੀੜ੍ਹੀ ਹੈ ਉਹ ਨਸ਼ੇ ਵੱਲ ਵੀ ਘੱਟ ਜਾਵੇ ਸਾਰੀ ਨਸ਼ੇ ਵੱਲ ਜਾ ਰਹੀ ਕਿ ਖੇਡਾਂ ਵਿੱਚ ਰੁਝਾਨ ਵਧੇਗਾ ਉਹਨਾਂ ਨੂੰ ਪ੍ਰੋਤਸਾਹਨ ਮਿਲੇਗਾ ਖੇਡਾਂ ਵਿੱਚ ਅੱਗੇ ਵਧਣਗੇ ਕਿਸੇ ਆਨ ਖੇਡਾਂ ਖਿਡਾਰੀ ਜੋ ਆਪਣੀ ਅਜੋਕੀ ਪੀੜ੍ਹੀ ਹੈ ਉਹ ਬਾਹਰ ਵੱਲ ਨਹੀਂ ਭੱਜੇਗੀ ਬਾਹਰਲੇ ਦੇਸ਼ਾਂ ਵੱਲ ਉਹਨਾਂ ਦਾ ਰੁਝਾਨ ਵੱਧ ਰਿਹਾ ਹੈ ਆਪਣੀ ਹੀ ਪੰ ਰਹਿ ਕੇ ਇਹਨਾਂ ਨੂੰ ਆਪਣੇ ਪੰਜਾਬ ਵਿੱਚ ਰਹਿ ਕੇ ਉਹਨਾਂ ਨੂੰ ਪਤਾ ਹੋਏ ਕਿ ਸਾਡੇ ਇੱਥੇ ਅੱਗੋਂ ਅਨ ਰੁਜ਼ਗਾਰ ਮਿਲ ਜਾਣਾ ਹੈ ਸਾਡਾ ਇੱਥੇ ਪ੍ਰੋਤਸਾਹਨ ਮਿਲਦਾ ਹੈ ਖੇਡਾਂ ਵਿੱਚ ਸਾਨੂੰ ਪ੍ਰੋਤਸਾਹਨ ਮਿਲਦਾ ਹੈ ਸਰਕਾਰ ਬਹੁਤ ਹੀ ਮਤਲਬ ਕਿ ਸਾਡੇ ਗ ਫੰਡ ਜਾਰੀ ਕਰ ਰਹੀ ਹੈ ਸਾਡੇ ਬਾਰੇ ਸੋਚ ਰਹੀ ਹੈ ਪਰ ਇ ਅਜਿਹਾ ਕੁਝ ਨਹੀਂ ਹੋ ਰਿਹਾ ਸਿਰਫ਼ ਬਹੁਤ ਸ ਖਿਡਾਰੀ ਆ ਇਕੱਲੇ ਮੈਡਲ ਲੈ ਕੇ ਹੀ ਘਰ ਬੈਠੇ ਹਨ ਅੱਗੇ ਅੱਗੇ ਉਹਨਾਂ ਨੂੰ ਕੁਛ ਰਸਤਾ ਹੀ ਨਹੀਂ ਦਿਖਾਈ ਦੇ ਰਿਹਾ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਇਸ ਲਈ ਬਹੁਤ ਸਾਰੇ ਫੰਡ ਜਾਰੀ ਕਰਨੇ ਚਾਹੀਦੇ ਹਨ ਅਗਰ ਜੇ ਮੈਨੂੰ ਵੀ ਕਿਸੇ 'ਚ ਮੌਕਾ ਮਿਲਦਾ ਹੈ ਸਪੋਰਟਸ ਵਿੱਚ ਤਾਂ ਮੈਂ ਵੀ ਜ਼ਰੂਰ ਜੋ ਸਰਕਾਰ ਕੁਝ ਸੋਚ ਰਹੀ ਹੈ ਤਾਂ ਮੈਂ ਵੀ ਆਪਣਾ ਰੁਝਾਨ ਜ਼ਰੂਰ ਵਿਖਾਵਾਂਗਾ ਧੰਨਵਾਦ